ਮੇਰੇ ਪਿੰਡ ਦਾ ਜੋ ਸਕੂਲ ਹੈ ਉਹ ਹਾਲੇ ਦੂੜੀ ਖਸਤਾ ਹਾਲਤ ਵਿੱਚ ਹੈ ਮੈਂ ਆਪਣੇ ਪਿੰਡ ਦੇ ਸਕੂਲ ਵਿੱਚ ਵਿੱਚ ਹਰ ਇੱਕ ਚੀਜ਼ ਦੀ ਸੁਵਿਧਾਵਾਂ ਜਿਹੜੀ ਹੈਗੀ ਉਹਨਾਂ ਦੀ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਸਕੂਲ ਵਿੱਚ ਪੀਣ ਵਾਲਾ ਪਾਣੀ ਕਿਤਾਬਾਂ ਅਤੇ ਬਚ ਬੱਚਿਆਂ ਲਈ ਬੈਠਣ ਦਾ ਜੋ ਪ੍ਰਬੰਧ ਹੈ ਬਿਲਕੁਲ ਵੀ ਸਹੀ ਨਹੀਂ ਅਤੇ ਜਿਹੜੇ ਸਕੂਲ ਦੀ ਬਿਲਡਿੰਗ ਹੈ ਉਹ ਕਾਫੀ ਜ਼ਿਆਦਾ ਪੁਰਾਣੀ ਹੈ ਅਤੇ ਸਕੂਲ ਦੀ ਜੋ ਚਾਰ ਦੀਵਾਰੀ ਹੈ ਉਹ ਵੀ ਨਹੀਂ ਹੋਈ ਹੋਈ ਜਿਸ ਕਾਰਨ ਬੱਚਿਆਂ ਨੂੰ ਬੈਠਣ ਵਿੱਚ ਕਾਫੀ ਦਿੱਕਤ ਪੇਸ਼ ਆਉਂਦੀ ਹੈ ਅਤੇ ਜਿਹੜਾ ਇਸ ਸਕੂਲ ਮੇਰੇ ਸਕੂਲ ਦੇ ਵਿੱਚੋਂ ਵਿ ਪਿੰਡ ਦੇ ਸਕੂਲ ਵਿੱਚ ਸੁਧਾਰ ਕਰਨ ਬਾਰੇ ਚੀਜ਼ਾਂ ਹਨ ਉਹ ਹਨ ਸਕੂਲ ਦੇ ਵਿੱਚ ਜੋ ਇਨਫਰਾਸਟਕਚਰ ਇਨਫਰਾਸਟਕਚਰ ਹੈ ਉਹ ਬਹੁਤ ਹੀ ਜ਼ਿਆਦਾ ਕਰਨ ਦੀ ਲੋੜ ਹੈ ਸਕੂਲ ਦੀ ਚਾਰ ਦੀਵਾਰੀ ਸਕੂਲ ਦੀ ਨਵੀਂ ਬਿਲਡਿੰਗ ਸਕੂਲ ਵਿੱਚ ਬੈਂਚ ਸਕੂਲ ਦੇ ਵਿੱਚ ਬੱਚਿਆਂ ਦੀ ਬੈਠਣ ਲਈ ਸਿਹਤ ਸੁਵਿਧਾਵਾਂ ਪੀਣ ਵਾਲਾ ਪਾਣੀ ਅਤੇ ਸਕੂਲ ਵਿੱਚ ਜੋ ਅ ਭੋ ਬੱਚਿਆਂ ਦੇ ਲਈ ਭੋਜਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਸਰਕਾਰ ਨੂੰ ਇਸ ਵਿੱਚ ਵੱਡੇ ਪੱਧਰ ਸੁ ਸਕ ਸੁ ਸੁਧਾਰ ਕਰਨ ਦੀ ਲੋੜ ਹੈ ਸਰਕਾਰ ਇਸ ਹਰ ਇੱਕ ਸਕੂਲਾਂ ਦੇ ਚੈਕਿੰਗ ਕਰਕੇ ਸਕੂਲਾਂ ਦੇ ਜਿਹੜੇ ਮਿਆਰ ਉੱਚਾ ਚੁੱਕਣ ਲਈ ਇਹਨਾਂ ਨੂੰ ਵਧੀਆ ਬਿਲਡਿੰਗ ਦਾ ਬਣਵਾ ਕੇ ਦੇਵੇ ਅਤੇ ਬੱਚਿਆਂ ਲਈ ਬੜਾ ਵਧੀਆ ਪੜ੍ਹਾਈ ਦਾ ਮਾਹੌਲ ਬਣੇ ਜਿਸ ਨਾਲ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਹੈ ਉਹ ਬਹੁਤ ਅੱਛੀ ਹੋ ਸਕਦੀ ਹੈ ਇਸ ਲਈ ਇਹਨਾ ਸੁਧਾਰਾਂ ਦੀ ਸਕੂਲਾਂ ਵਿੱਚ ਫੌਰੀ ਤੌਰ 'ਤੇ ਲੋੜ ਹੈ